ਸਾਡੀ ਦਸਵੀਂ ਜਮਾਤ ਦੇ ਵਿੱਚ ਸਾਨੂੰ ਪੇਂਟਿੰਗ ਸਿਖਾਈ ਜਾਂਦੀ ਸੀ ਉਦੋਂ ਸਾਡੀ ਦੀ ਅਧਿਆਪਕ ਨੇ ਸਾਨੂੰ ਸਾਹਮਣੇ ਪਈ ਚੀਜ਼ਾਂ ਨੂੰ ਹੱਥੀਂ ਬਣਾਉਣਾ ਸਿਖਾਇਆ ਕਿ ਕਿਸ ਤਰੀਕੇ ਨਾਲ ਅਸੀਂ ਸਾਹਮਣੇ ਪਈ ਚੀਜ਼ ਨੂੰ ਆਪਣੀ ਉਸ ਕਾਗਜ਼ 'ਤੇ ਉਸੀ ਸੇਮ ਤਰੀਕੇ ਦੇ ਨਾਲ ਉਤਾਰ ਸਕਦੇ ਹਾਂ ਔਰ ਉਸ ਅ ਬਣੀ ਪੇਂਟਿੰਗ ਦੇ ਨੇ ਮੈਨੂੰ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕੀਤਾ ਅਤੇ ਉਸ ਤੋਂ ਬਾਅਦ ਮੈਂ ਹੁਣ ਮੁੱਖ ਤੌਰ 'ਤੇ ਕਾਲਜ ਵਿੱਚ ਆ ਕੇ ਪੇਂਟਿੰਗ ਨੂੰ ਹੀ ਆਪਣਾ ਸਬਜੈਕਟ ਚੁਣ ਲਿਆ